ਮੈਂ ਨਿੱਜੀ ਤੌਰ 'ਤੇ ਹਿੰਦੂ ਧਰਮ ਨਾਲ ਸੰਬੰਧ ਰੱਖਦੀ ਹਾਂ ਪਰ ਮੇਰੇ ਮਨ ਵਿੱਚ ਸਭਨਾ ਧਰਮਾਂ ਸਿੱਖ ਇਸਾਈ ਹਿੰਦੂ ਮੁਸਲਮਾਨ ਆਦਿ ਸਭ ਧਰਮਾਂ ਲਈ ਬਰਾਬਰ ਆਦਰ ਅਤੇ ਸਤਿਕਾਰ ਹੈ ਮੇਰੇ ਖੇਤਰ ਵਿੱਚ ਮੈਂ ਲਗਾਤਾਰ ਸਿੱਖ ਧਰਮ ਦਾ ਪ੍ਰਸਾਰ ਦੇਖ ਰਹੀ ਹਾਂ ਸਾਡੇ ਨੇੜੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਕਵਿਤਾ ਗਾਇਨ ਮੁਕਾਬਲੇ ਪਾਠਾਂ ਦੀ ਲੜੀ ਦੇ ਮੁਕਾਬਲੇ ਅਤੇ ਗੱਤਕੇ ਦੇ ਮੁਕਾਬਲੇ ਕਰਵਾ ਕੇ ਬੱਚਿਆਂ ਨੂੰ ਧਰਮ ਨਾਲ ਜੋੜਿਆ ਜਾ ਰਿਹਾ ਹੈ ਵੀਡੀਓ ਕੈਸ਼ਟਾਂ ਅਤੇ ਕੀਰਤਨ ਸਮਾਗਮਾਂ ਦੌਰਾਨ ਲੋਕਾਂ ਦਾ ਇਨਟ ਲੋਕਾਂ ਦਾ ਲਗਾਤਾਰ ਵੱਧਦਾ ਹੋਇਆ ਰੁਝਾਨ ਸਿੱਖ ਧਰਮ ਨੂੰ ਇੱਕ ਅਸਲ ਮੰਜ਼ਿਲ 'ਤੇ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ